ਮੋਹਾਲੀ ਜ਼ਿਲ੍ਹੇ ਵਿੱਚ ਛੇ ਫੇਜ਼ ਵਿੱਚ ਇੱਕ ਸਰਕਾਰੀ ਹੌਸਪੀਟਲ ਹੈ ਉਸ ਤੋਂ ਬਾਅਦ ਪ੍ਰਾਈਵੇਟ ਹੌਸਪੀਟਲ ਜਿਵੇਂ ਕਿ ਮੈਕਸ ਫੋਰਟੀਸ ਅਮਨ ਹੌਸਪੀਟਲ ਹੋਰ ਕਾਫ਼ੀ ਸਿਰਪ ਗੋਲਡਨ ਹੋਰ ਕਾਫ਼ੀ ਹੌਸਪੀਟਲ ਹਾ ਪ੍ਰਾਈਵੇਟ ਹਨ ਅਤੇ ਜਿੰਨ੍ਹਾਂ ਵਿੱਚ ਕੋਵਿਡ ਟਾਈਮ ਬਹੁਤ ਜ਼ਿਆਦਾ ਸਹੂਲਤਾਂ ਵੀ ਸੀ ਅਤੇ ਬਹੁਤ ਅੱਛੇ ਇਲਾਜ਼ ਵੀ ਕੀਤੇ ਜਾਂਦੇ ਸੀ ਅਤੇ ਉਹਨਾਂ ਦੀ ਸਾਨੂੰ ਬਹੁਤ ਅੱਛੀ ਹੈਲਪ ਮਿਲੀ ਹੈ ਜਿਉਂ ਕਿ ਜਿਵੇਂ ਕਿ ਸਾਡੀਆਂ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਸਾਨੂੰ ਉਹਨਾਂ ਦੀ ਬਹੁਤ ਸੁਵਿਧਾ ਮਿਲੀ ਹੈ